ਰੋਜ਼ਾਨਾ ਦੇ ਤੌਰ 'ਤੇ ਔਰਤਾਂ ਨੂੰ ਆਉਣ ਵਾਲੀਆਂ ਸਮੱਸਿਆ ਵਿੱਚ ਜਿੱਦਾਂ ਕਿ ਔਰਤਾਂ ਦੀ ਸੇਫਟੀ ਅਤੇ ਸੁਰੱਖਿਆ ਨੂੰ ਲੈ ਕੇ ਔਰਤਾਂ ਨੂੰ ਕਾਫੀ ਸਾਹਮਣਾ ਕਰਨਾ ਪੈਂਦਾ ਹੈ ਪਿਛਲੇ ਸਾਲਾਂ ਦੌਰਾਨ ਔਰਤਾਂ ਦੀ ਭੂਮਿਕਾ ਕਾਫੀ ਤੌਰ 'ਤੇ ਬਦਲੀ ਹੈ ਜਿਸ ਤਰ੍ਹਾਂ ਕਿ ਇਲੈਕਟ੍ਰੋਨਿਕਸ ਯੁੱਗ ਆਉਣ ਦੇ ਨਾਲ ਔਰਤਾਂ ਦੇ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ ਹੈ ਜਿਸ ਵਿੱਚ ਖਾਸ ਤੌਰ 'ਤੇ ਮੋਬਾਇਲ ਮੋਬਾਇਲ ਦੇ ਨਾਲ ਜਿਸ ਤਰ੍ਹਾਂ ਹੀ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਟੋਪਿਕ ਪੜ੍ਹੀਆਂ ਲਿਖੀਆਂ ਔਰਤਾਂ ਨੂੰ ਜੇਕਰ ਕੋਈ ਨਹੀਂ ਪਤਾ ਲੱਗਦਾ ਤਾਂ ਉਹ ਗੂਗਲ ਦੇ ਮਾਧਿਅਮ ਰਾਹੀਂ ਜਿਸ ਤਰ੍ਹਾਂ ਖਾਣਾ ਬਣਾਉਣਾ ਜਾਂ ਕੋਈ ਸਿਲਾਈ ਅਤੇ ਕਢਾਈ ਦਾ ਕੰਮ ਸਿੱਖਣ ਵਾਸਤੇ ਔਰਤਾਂ ਨੂੰ ਇਲੈਕਟ੍ਰੋਨਿਕਸ ਯੁੱਗ ਦੇ ਵਿੱਚ ਕਾਫੀ ਮਦਦ ਮਿਲੀ ਹੈ ਇਸ ਅਤੇ ਇਸ ਇਹ ਵਧੀਆ ਖਾਣਾ ਬਣਾਉਣਾ ਗੂਗਲ ਦੇ ਰਾਹੀਂ ਸਿੱਖਣ ਵਿੱਚ ਮਦਦ ਮਿਲਦੀ ਹੈ ਅਜੇ ਵੀ ਕਾਫੀ ਦੇਸ਼ ਅਤੇ ਕਾਫੀ ਸੂਬੇ ਅਤੇ ਕਾਫੀ ਇਲਾਕੇ ਇਹੋ ਜਿਹੇ ਪਾਏ ਜਾਂਦੇ ਹਨ ਜਿਨ੍ਹਾਂ ਵਿੱਚ ਅਜੇ ਵੀ ਔਰਤਾਂ ਸੁਰੱਖਿਅਤ ਨਹੀਂ ਹਨ ਜਿਸ ਤਰ੍ਹਾਂ ਯੂਪੀ ਅਤੇ ਹੋਰ ਕਾਫੀ ਔਰਤਾਂ ਦੇ ਨਾਲ ਬਦਸਲੂਕੀ ਅਤੇ ਕਾਫੀ ਤਰ੍ਹਾਂ ਦਾ ਧੱਕਾ ਬਲਾਤਕਾਰ ਵਗੈਰਾ ਐਸੇ ਕਈ ਘਿਨਾਉਣੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਜਿਸ ਤਰ੍ਹਾਂ ਇਹਨਾਂ ਦੇਸ਼ਾਂ ਦੇ ਵਿੱਚ ਇਹਨਾਂ ਸਟੇਟਾਂ ਦੇ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ ਅਤੇ ਔਰਤਾਂ ਨੌਕਰੀ ਜਿੱਦਾਂ ਸਰਕਾਰੀ ਨੌਕਰੀਆਂ ਦੇ ਵਿੱਚ ਪੰਜਾਹ ਪ੍ਰਸੈਂਟ ਰਿਜਰਵਰੇਸ਼ਨ ਜਨਾਨੀਆਂ ਨੂੰ ਦਿੱਤੀ ਜਾਂਦੀ ਹੈ ਜਿਸ ਇਸ ਰਿਜ਼ਰਵਰੇਸ਼ਨ ਦੇ ਨਾਲ ਇਨ੍ਹਾਂ ਨੂੰ ਅੱਗੇ ਨੌਕਰੀ ਕਰਨ ਦੇ ਵਿੱਚ ਅਤੇ ਨੌਕਰੀ ਲੈਣ ਦੇ ਵਿੱਚ ਕਾਫੀ ਮਦਦ ਮਿਲਦੀ ਹੈ ਅੱਜ ਕੱਲ੍ਹ ਦੀਆਂ ਔਰਤਾਂ ਹਨ ਜ਼ਿਆਦਾਤਰ ਪੰਜਾਹ ਪ੍ਰਸੈਂਟ ਪੜ੍ਹੀਆਂ ਲਿਖੀਆਂ ਹੋਣ ਕਰਕੇ ਆਪਣੇ ਬੱਚਿਆਂ ਨੂੰ ਵਧੀਆ ਅੱਗੇ ਪੜ੍ਹਾਉਣ ਦੇ ਵਿੱਚ ਸਮਰੱਥ ਹਨ